ਅੱਜ ਦੇ ਜ਼ਮਾਨੇ ਦੇ ਵਿੱਚ ਹਰ ਇਲਾਕਿਆਂ ਦੀ ਹਰ ਇਲਾਕੇ ਦੇ ਵਿੱਚ ਬਹੁਤ ਸਾਰੇ ਅਪਰਾਧ ਹੋ ਰਹੇ ਨੇ ਲੋਕ ਲੁੱਟ ਖਸੁੱਟ ਲੋਕ ਇੱਕ ਦੂਜੇ ਕੋਲੋਂ ਕਦੀ ਕੋਈ ਹੱਥੀ ਭੜੱਥੀ ਕਿਸੇ ਤਰੀਕੇ ਵੀ ਸੋਚਦੇ ਨੇ ਕਿ ਸਾਡੇ ਕੋਲ ਪੈਸਾ ਆ ਜਾਣਾ ਚਾਹੀਦਾ ਹੈ ਤਰਕੀਬ ਕੋਈ ਵੀ ਸੋਚ ਲੈਂਦੇ ਨੇ ਉਹਦੇ ਲਈ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਇੱਕ ਤਾਂ ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਵਿਖਾਵੇ ਭਰੀ ਬੜੀ ਜ਼ਿੰਦਗੀ ਹੈ ਲੋਕ ਦੂਸਰਿਆਂ ਨੂੰ ਦੇਖਦੇ ਨੇ ਵਧੀਆ ਚੀਜ਼ਾਂ ਮਟੀਰੀਅਲਿਸਟਿਕ ਲੋਕ ਹੋ ਚੁੱਕੇ ਨੇ ਵਿਖਾਵਾ ਹੈ ਵਧੀਆ ਫੋਨ ਦੂਜੇ ਕੋਲੋਂ ਫੜੇ ਹੋਏ ਹੁੰਦੇ ਨੇ ਵਧੀਆ ਗੱਡੀ ਹੈ ਕਿਸੇ ਕੋਲੋਂ ਵਧੀਆ ਕੱਪੜੇ ਕਿਸੇ ਨੇ ਪਾਏ ਨੇ ਕੱਪੜੇ ਦੀ ਵਰਾਇਟੀ ਬੜੀ ਚਾਹੀਦੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਪੂਰੀਆਂ ਕਰਨ ਲਈ ਉਹ ਆਮ ਬੰਦਾ ਜਿਹੜਾ ਮਿਹਨਤ ਕਰਦਾ ਹੈ ਨੌਕਰੀ ਕਰਦਾ ਹੈ ਬਿਜਨਸ ਕਰਦਾ ਹੈ ਇੰਨੇ ਪੈਸੇ ਉੱਥੋਂ ਮਿਲਦੇ ਨਹੀਂ ਤਾਂ ਫਿਰ ਲੋਕ ਜਿਹੜੇ ਨੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਰਾਤੋ ਰਾਤ ਕਹਿੰਦੇ ਨੇ ਅਸੀਂ ਅਮੀਰ ਹੋ ਜਾਈਏ ਉਹਦੇ ਲਈ ਉਹ ਗਲਤ ਕੰਮਾਂ ਵੱਲ ਤੁਰ ਪੈਂਦੇ ਨੇ ਇਹਦੇ ਲਈ ਮਹਿੰਗਾਈ ਵੀ ਇੱਕ ਬਹੁਤ ਵੱਡਾ ਕਾਰਨ ਹੈ ਮਹਿੰਗਾਈ ਜਿਹੜੀ ਦਿਨ ਬ ਦਿਨ ਵਧੀ ਜਾ ਰਹੀ ਹੈ ਅਤੇ ਲੋਕਾਂ ਦੀ ਪੂਰੀ ਪੈਂਦੀ ਨਹੀਂ